ਪੰਜਾਬ ਵਿੱਚ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਬਹੁਤ ਹੀ ਚਾਅ ਨਾਲ ਖਾਇਆ ਜਾਂਦਾ ਹੈ ਅਤੇ ਮੈਨੂੰ ਵੀ ਇਹ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ ਮੈਂ ਵੀ ਇਸ ਨੂੰ ਬਹੁਤ ਹੀ ਧਿਆਨ ਨਾਲ ਅਤੇ ਪਿਆਰ ਨਾਲ ਬਣਾਉਂਦੀ ਹਾਂ ਸ ਮੱਕੀ ਦੀ ਰੋਟੀ ਮੱਕੀ ਦਾ ਆਟਾ ਗੁੰਨ ਕੇ ਉਸਨੂੰ ਨਾਲ਼ ਬਣ ਅਸ ਬਣਦੀ ਹੈ ਅਤੇ ਇਸਨੂੰ ਅਸੀਂ ਜ਼ਿਆਦਾਤਰ ਚੁੱਲ੍ਹੇ 'ਤੇ ਹੀ ਬਣਾਉਂਦੇ ਹਨ ਸਾਗ ਸਾਗ ਅਸੀਂ ਪਹਿਲਾਂ ਸਾਗ ਨੂੰ ਪਹਿਲਾਂ ਖੇਤਾਂ ਤੋਂ ਪੁੱਟ ਕੇ ਲਿਆਇਆ ਜਾਂਦਾ ਹੈ ਅਤੇ ਫਿਰ ਉਸਨੂੰ ਸਾਫ਼ ਪੱਤੇ ਕਰੇ ਜਾਂਦੇ ਆ ਉਸਦੇ ਅਤੇ ਫਿਰ ਉਸਨੂੰ ਅੱਛੀ ਤਰ੍ਹਾਂ ਕੱਟ ਕੇ ਧੋ ਕੇ ਫਿਰ ਉਸਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਅਤੇ ਨਮਕ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਉਸ 'ਚ ਆਲ੍ਹਣ ਪਾਇਆ ਜਾਂਦਾ ਹੈ ਅਤੇ ਫਿਰ ਉਸਨੂੰ ਅੱਛੀ ਤਰ੍ਹਾਂ ਘੋਟਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਉਸਨੂੰ ਹੋਰ ਸਵਾਦਿਸ਼ਟ ਬਣਾਉਣ ਲਈ ਪਿਆਜ਼ ਲੱਸਣ ਅਤੇ ਅਦਰਕ ਹਰੀ ਮਿਰਚ ਇਹਨਾਂ ਚੀਜ਼ਾਂ ਦਾ ਤੜਕਾ ਲਾਇਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਇਸ ਨੂੰ ਮੱਕੀ ਦੀ ਰੋਟੀ ਅਤੇ ਮੱਖਣ 'ਤੇ ਲੱਸੀ ਆਦਿ ਨਾਲ਼ ਖਾਇਆ ਜਾਂਦਾ ਹੈ ਇਹ ਪੰਜਾਬ ਵਿੱਚ ਬਹੁਤ ਹੀ ਮਸ਼ਹੂਰ ਹੈ